ਯੁੱਗਾਂ ਯੁੱਗਾਂ ਤੋਂ ਭੰਗੜਾ ਪੰਜਾਬੀ ਸਭਿਆਚਾਰ ਦਾ ਅਭਿੰਨ ਅੰਗ ਰਿਹਾ ਹੈ ਸਾਰੇ ਖੁਸ਼ੀ ਦੇ ਪਲਾਂ ਵਿੱਚ ਭੰਗੜਾ ਜਾਨ ਫੂਕ ਦਿੰਦਾ ਹੈ ਕਈ ਕਾਰਜ ਭੰਗੜੇ ਤੋਂ ਬਿਨਾਂ ਅਧੂਰੇ ਹਨ ਜਿਵੇਂ ਵਿਆਹ ਸ਼ਾਦੀ ਜਿਸ ਵਿੱਚ ਵਿਆਹ ਤੋਂ ਕਾਫੀ ਦਿਨ ਪਹਿਲਾਂ ਹੀ ਡੀ ਜੇ ਉੱਪਰ ਭੰਗੜਾ ਪਾਉਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਅਤੇ ਬਰਾਤ ਵਾਲੇ ਦਿਨ ਹਰ ਇੱਕ ਪਰਿਵਾਰਕ ਮੈਂਬਰ ਭੰਗੜਾ ਪਾਉਣਾ ਆਪਣੀ ਸ਼ਾਨ ਸਮਝਦਾ ਹੈ ਇਸ ਤੋਂ ਇਲਾਵਾ ਜਦੋਂ ਘਰ ਵਿੱਚ ਬੱਚੇ ਦਾ ਜਨਮ ਹੁੰਦਾ ਹੈ ਤਾਂ ਉਸਦੀ ਖੁਸ਼ੀ ਵਿੱਚ ਅਤੇ ਉਸਦੀ ਪਹਿਲੀ ਲੋਹੜੀ ਵਾਲੇ ਦਿਨ ਢੋਲ 'ਤੇ ਭੰਗੜਾ ਪਾਉਣ ਦੀ ਰਸਮ ਪੰਜਾਬ ਦੀ ਇੱਕ ਖ਼ਾਸ ਰਸਮ ਹੈ ਇਸ ਤੋਂ ਇਲਾਵਾ ਲੋਹੜੀ ਦਾ ਤਿਉਹਾਰ ਭੰਗੜੇ ਤੋਂ ਬਿਨਾਂ ਅਧੂਰਾ ਮੰਨਿਆ ਜਾਂਦਾ ਹੈ ਅੱਜ ਕੱਲ੍ਹ ਪੰਜਾਬੀ ਗਾਣਿਆਂ ਦਾ ਫਿਲਮਾਂਕਣ ਵੀ ਭੰਗੜੇ ਨਾਲ ਹੀ ਜ਼ਿਆਦਾਤਰ ਕੀਤਾ ਜਾਂਦਾ ਹੈ ਸਾਰੇ ਸਕੂਲ ਕਾਲਜਾਂ ਵਿੱਚ ਗਣਤੰਤਰ ਦਿਵਸ ਜਾਂ ਆਜ਼ਾਦੀ ਦਿਵਸ ਪੰਦਰਾਂ ਅਗਸਤ ਵਾਲੇ ਦਿਨ ਬੱਚੇ ਅਤੇ ਜਵਾਨ ਭੰਗੜਾ ਪਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦੇ ਹਨ ਅੱਜ ਕੱਲ੍ਹ ਤਾਂ ਵਿਦੇਸ਼ਾਂ ਵਿੱਚ ਵੀ ਭੰਗੜੇ ਦੀ ਬਹੁਤ ਚਰਚਾ ਹੈ ਜਿੱਥੇ ਜਿੱਥੇ ਵੀ ਪੰਜਾਬੀ ਵਸੇ ਹਨ ਉਹਨਾਂ ਨੇ ਉਥੋਂ ਦੇ ਸੱਭਿਆਚਾਰ ਨੂੰ ਵੀ ਭੰਗੜੇ ਵਿੱਚ ਰੰਗ ਦਿੱਤਾ ਹੈ ਭੰਗੜੇ ਦੇ ਕੁਝ ਸਟੈਪ ਹਨ ਜਿਵੇਂ ਕਿ ਜੁਗਨੀ ਝੂਮਰ ਲਹਿਰੀਆ ਟੱਪਾ ਧਮਾਲ ਲੁੱਡੀ ਢੋਲ ਸੰਮੀ ਡਬਲ ਮਾਈਆ ਸਿੰਗਲ ਟੱਪਾ ਚੁਟਕੀ ਲਹਿਰੀਆ ਸਿੰਗਲ ਹੈਂਡ ਲਹਿਰੀਆ ਫੁੱਲ ਫੁੱਲ ਰਿਮਕਸ ਤਾਰੀ ਝੂਮਰ ਪੰਪ ਤਾਰੀ ਸ਼ੀਸ਼ਾ ਰਿਮਿਕਸ ਇਸ ਤਰ੍ਹਾਂ ਭੰਗੜੇ ਦੇ ਭਿੰਨ ਭਿੰਨ ਰੂਪ ਹਨ ਜਿਹਨਾਂ ਨਾਲ ਭੰਗੜੇ ਨੂੰ ਚਾਰ ਚੰਦ ਲਾਏ ਜਾਂਦੇ ਹਨ ਪੁਰਾਣੇ ਸਮਿਆਂ ਵਿੱਚ ਤਾਂ ਸਾਡੇ ਬਜ਼ੁਰਗ ਵੀ ਪੁਰਾਣੇ ਤਰੀਕੇ ਨਾਲ ਜਿਵੇਂ ਲਹਿੰਦੇ ਪਾਕਿਸਤਾਨ ਜਾਂ ਪੰਜਾਬ ਦੇ ਵਿੱਚ ਭੰਗੜਾ ਪਾਉਂਦੇ ਹਨ ਇਸ ਕਰਕੇ ਭੰਗੜਾ ਪੰਜਾਬ ਦਾ ਇੱਕ ਮੁੱਖ ਸੱਭਿਆਚਾਰ ਹੈ